ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਤੁਸੀਂ ਨਾ ਫਤਿਹਗੜ੍ਹ ਸਾਹਿਬ ਹੁਣੇ ਆ ਕੇ ਵਿਜਿਟ ਕਰ ਲਓ ਕਿਉਂਕਿ ਹੁਣ ਸ਼ਹੀਦੇ ਜੋੜ ਮੇਲਾ ਚੱਲ ਰਿਹਾ ਜੀ ਅਤੇ ਇੱਥੇ ਘੁੰਮਣ ਨੂੰ ਵੀ ਮੌਸਮ ਐਨ ਬਿਲਕੁਲ ਠੀਕ ਆ ਵਧੀਆ ਠੰਡਾ ਅਤੇ ਇੱਥੇ ਘੁੰਮਣ ਨੂੰ ਫ ਗੁਰਦੁਆਰਾ ਸ਼੍ਰੀ ਫਤਿਹਗੜ੍ਹ ਸਾਹਿਬ ਅਤੇ ਸ਼੍ਰੀ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਆ ਅਤੇ ਗੁਰੂ ਗੋ ਸਾਹਿਬਜ਼ਾਦਿਆਂ ਨੂੰ ਵਜ਼ੀਰ ਖਾਨ ਨੇ ਨੀਹਾਂ ਵਿੱਚ ਚਿਣਵਾ ਦਿੱਤਾ ਸੀ ਇੱਥੇ ਦਾ ਇਤਿਹਾਸ ਤੁਹਾਨੂੰ ਬਹੁਤ ਜਾਣਕਾਰੀ ਮਿਲੇਗੀ ਇੱਥੋਂ ਅਤੇ ਗੁਰਦੁਆਰਾ ਸ਼੍ਰੀ ਜੋਤੀ ਸਰੂਪ ਸਾਹਿਬ ਉਹਨਾਂ ਦਾ ਸੰਸਕਾਰ ਕੀਤਾ ਗਿਆ ਸੀ ਅਤੇ ਫਤਿਹਗੜ੍ਹ ਸਾਹਿਬ ਬਹੁਤ ਹੀ ਇੱਕ ਸੁੰਦਰ ਜਗ੍ਹਾ ਸੁੰਦਰ ਸਿਟੀ ਹੈ ਅਤੇ ਤੁਸੀਂ ਜ਼ਰੂਰ ਇੱਥੇ ਆ ਕੇ ਵਿਜਿਟ ਕਰੋ ਹਾਂਜੀ ਹਾਂਜੀ ਆ ਆਮ ਖਾਸ ਬਾਗ ਵੀ ਤੁਸੀਂ ਜਾ ਸਕਦੇ ਓਂ ਉਹ ਇੱਕ ਬਹੁਤ ਹੀ ਪੁਰਾਣੀ ਬਹੁਤ ਹੀ ਜ਼ਿਆਦਾ ਪੁਰਾਣੀ ਇਮਾਰਤ ਹੈ ਜੋ ਕਿ ਪੁਰਾਣੇ ਟਾਈਮ ਦੇ ਜੋ ਰਾਜਾ ਮਹਾਰਾਜਾ ਸੀਗੇ ਉਹਨਾਂ ਨੇ ਬਣਵਾਈ ਹੋਈ ਸੀ

ਤੁਸੀਂ ਰੇਲਵੇ ਰਾਹੀਂ ਵੀ ਆ ਸਕਦੇ ਓਂ ਬੱਸ ਬੱਸ ਰਾਹੀਂ ਵੀ ਆ ਸਕਦੇ ਓਂ ਰੇਲਵੇ ਸਟੇਸ਼ਨ ਫਤਿਹਗੜ੍ਹ ਸਾਹਿਬ ਅਤੇ ਸਰਹੰਦ ਸ਼ਹਿਰ ਨੇੜੇ ਪੈਂਦਾ ਫਤਿਹਗੜ੍ਹ ਸਾਹਿਬ ਦੇ ਸਰਹੰਦ ਸ਼ਹਿਰ ਰੇਲਵੇ ਸਟੇਸ਼ਨ ਹੈਗਾ

ਚੰਡੀਗੜ੍ਹ ਚੰਡੀ ਚੰਡੀਗੜ੍ਹ ਤੋਂ ਚਾਲ੍ਹੀ ਕਿਲੋਮੀਟਰ ਚੰਡੀਗੜ੍ਹ ਚੰਡੀਗੜ੍ਹ ਆ ਸਕਦੇ ਹੋ ਬਾਏ ਏਅਰ ਉੱਥੋਂ ਫਿਰ ਤੁਸੀਂ ਟਰੇਨ ਜਾਂ ਬੱਸ ਆ ਸਕਦੇ ਹੋ ਹਾਂਜੀ ਅਤੇ ਤੁਸੀਂ ਆ ਕੇ ਸਰ ਮੈਨੂੰ ਇੱਕ ਵਾਰੀ ਇੱਥੇ ਕੋਲ ਕਰ ਲਿਓ